ਮੈਨੂੰ ਬੱਸ ਦਾ ਸਫ਼ਰ ਬਹੁਤ ਵਧੀਆ ਲੱਗਦਾ ਹੈ ਮੈਂ ਲੰਬੇ ਰੂਟਾਂ 'ਤੇ ਅਕਸਰ ਬੱਸ ਉੱਤੇ ਹੀ ਸਫ਼ਰ ਕਰਦਾ ਜ਼ਿਆਦਾਤਰ ਜਿਹੜਾ ਸਫ਼ਰ ਹੈ ਬੱਸ 'ਚ ਮੈਨੂੰ ਪਹਾੜੀ ਰੂਟ ਦਾ ਹੀ ਵਧੀਆ ਲੱਗਦਾ ਪਹਾੜਾਂ ਦੇ ਵਿੱਚ ਐਵੇਂ ਹੁੰਦਾ ਕੇ ਸਾਨੂੰ ਕੁਦਰਤ ਨਾਲ ਜੁੜਨ ਦਾ ਵੀ ਮੌਕਾ ਮਿਲਦਾ ਹੈ ਅਤੇ ਜਦੋਂ ਮੋੜ ਆਉਂਦੇ ਨੇ ਪਹਾੜੀਆਂ ਦੇ ਵਿੱਚ ਅਤੇ ਉਹ ਬੜਾ ਕਸ਼ਿਕ ਇੱਕ ਚੀਜ਼ ਬਣ ਜਾਂਦੀ ਹੈ ਅਤੇ ਰੋਮਾਂਚ ਬਣਿਆ ਰਹਿੰਦਾ ਹੈ